ਹਾਂਜੀ ਅਸੀਂ ਸਾਡੇ ਬਹੁਤ ਮੌਜਾਂ ਹੁੰਦੀਆਂ ਨੇ ਅਸੀਂ ਮੰਦਰਾਂ 'ਚ ਜਾਂਦੇ ਹਾਂ ਢੋਲਕੀਆਂ ਚਿਮਟੇ ਵਜਾਉਂਦੇ ਹਾਂ ਕੀਰਤਨ ਕਰਦੇ ਹਾਂ ਸਾਨੂੰ ਬੜਾ ਮਜ਼ਾ ਆਉਂਦਾ ਉੱਥੇ ਭਗਵਾਨ ਦਾ ਨਾਮ ਲੈਂਦੇ ਹਾਂ ਸਭ ਕੁਝ ਕਰਦੇ ਹਾਂ ਕਿਸੇ ਦੇ ਘਰ ਜਾਈਏ ਉੱਥੇ ਵੀ ਅਸੀਂ ਕੀਰਤਨ ਕਰਦੇ ਹਾਂ ਨਾਚ ਗਾਣਾ ਹੁੰਦਾ ਹੈ ਲੋਕ ਬੜੇ ਖੁਸ਼ ਹੁੰਦੇ ਨੇ ਅਸੀਂ ਵੀ ਬੜੇ ਖੁਸ਼ ਹੋ ਜਾਂਦੇ ਹਾਂ ਸਾਡੇ ਮੰਡ ਇਹ ਭਜਨਾਂ ਦੀ ਮੰਡਲੀ ਹੈ ਉਹ ਮੰਦਰਾਂ ਦੇ ਵਿੱਚ ਹਰ ਰੋਜ਼ ਜਾਂਦੇ ਨੇ ਕੀਰਤਨ ਕਰਦੇ ਨੇ ਭਗਵਾਨ ਦਾ ਨਾਮ ਲੈਂਦੇ ਹੈ ਨੱਚਦੇ ਟੱਪਦੇ ਹੈ ਬੜਾ ਆਨੰਦ ਆਉਂਦਾ ਹੈ ਹਾਂਜੀ ਸਾਡੇ ਮਹਾਰਾਜ ਗੁਰੂ ਮਹਾਰਾਜ ਨੇ ਜਿਹੜੇ ਉਹ ਭਗਵਾਨ ਦਾ ਨਾਮ ਲੈਂਦੇ ਰਹਿੰਦੇ ਬੈਠੇ ਜੀ ਬਹੁਤ ਖੁ ਕੀਰਤਨ ਮੰਡਲੀ 'ਚ ਅਤੇ ਬਹੁਤ ਖੁਸ਼ ਨੇ ਹਾਂ ਭਗਵਾਨ ਦੀ ਕਿਰਪਾ ਬਹੁਤ ਕਿਰਪਾ ਹੈ ਭਗਵਾਨ ਦੀ ਉਹਨਾਂ 'ਤੇ ਸੰਤਾਂ ਦੀ ਵੀ ਘੰਟੀਆਂ ਢੋਲਕੀਆਂ ਚਿਮਟੇ ਵਜਾਉਂਦੇ ਨੇ ਬੜਾ ਆਨੰਦ ਲੈਂਦੇ ਨੇ